ਦੋ ਸੌ ਚਾਲ੍ਹੀ ਦਸ ਹਜ਼ਾਰ ਤਿੰਨ ਸੌ ਪੰਜਾਹ ਚਾਲ੍ਹੀ ਹਜ਼ਾਰ ਪੰਜ ਸੌ ਸੱਠ ਇੱਕ ਲੱਖ ਵੀਹ ਹਜ਼ਾਰ ਅੱਠ ਲੱਖ ਚਾਲ੍ਹੀ ਹਜ਼ਾਰ ਤਿੰਨ ਸੌ ਤੀਹ